ਸਿੱਖ ਇਤਿਹਾਸ ਵਿੱਚ ਮਹਿਲਾਵਾਂ ਬੀਬੀਆਂ ਦਾ ਬਹੁਤ ਵਿਸ਼ੇਸ਼ ਯਗਦਾਨ ਯੋਗਦਾਨ ਰਿਹਾ ਹੈ ਜਿਸ ਦੇ ਨਾਲ ਇਤਿਹਾਸ ਵਿੱਚ ਸਿੱਖ ਧਰਮ ਨੂੰ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੋਇਆ ਹੈ ਇਹਨਾਂ ਮਹਿਲਾਵਾਂ ਨੇ ਇੱਕ ਅਜਿਹੀ ਕੜੀ ਦਾ ਕੰਮ ਕੀਤਾ ਅਤੇ ਸਿੱਖਾਂ ਸਿੱਖਾਂ ਵਿੱਚ ਅਜਿਹਾ ਯੋਗਦਾਨ ਅਤੇ ਹੌਂਸਲਾ ਦਿੱਤਾ ਕਿ ਸਿੱਖ ਧਰਮ ਵਿੱਚ ਜੋ ਲੜੀਆਂ ਲੜਾਈਆਂ ਉਹਨਾਂ ਵਿੱਚ ਵਿਸ਼ੇਸ਼ ਜਿੱਤ ਪ੍ਰਾਪਤ ਹੋਈ ਸਿੱਖ ਇਤਿਹਾਸ ਵਿੱਚ ਬੀਬੀ ਰਜਨੀ ਦਾ ਵਿਸ਼ੇਸ਼ ਯੋਗਦਾਨ ਮਿਲਦਾ ਹੈ ਜਿਸ ਨੇ ਈਸ਼ਵਰ ਅਤੇ ਇੱਕ ਭਗਤ ਦੇ ਵਿਚਕਾਰਲੇ ਰਿਸ਼ਤੇ ਨੂੰ ਬੜੇ ਡੂੰਘੀ ਨਾਲ ਤੀਬਰਤਾ ਨਾਲ ਬਿਆਨ ਕੀਤਾ ਹੈ ਅਤੇ ਆਤਮਾ ਅਤੇ ਪਰਮਾਤਮਾ ਦੇ ਵਿਸ਼ਵਾਸ ਦਾ ਵਿਸ਼ਵਾਸ ਨੂੰ ਉਜਾਗਰ ਕੀਤਾ ਹੈ ਬੀਬੀ ਰਜਨੀ ਜੋ ਕਿ ਪਰਮਾਤਮਾ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੀ ਸੀ ਜਿਸ ਨੇ ਇਤਿਹਾਸ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜੋ ਕਿ ਇਤਿਹਾਸ ਵਿੱਚ ਲਿਖੀ ਗਈ ਜਿਸ 'ਤੇ ਅੱਜ ਕੱਲ੍ਹ ਫਿਲਮਾਂ ਵੀ ਬਣ ਰਹੀਆਂ ਹਨ ਆਉਣ ਵਾਲੇ ਸਮੇਂ ਵਿੱਚ ਫਿਲਮਾਂ ਵੀ ਬਣ ਰਹੀਆਂ ਹਨ ਬੀਬੀ ਰਜਨੀ ਜੋ ਕਿ ਪਰਮਾਤਮਾ ਵਿੱਚ ਬਹੁਤ ਵਿਸ਼ਵਾਸ ਰੱਖਦੀ ਸਨ ਪ੍ਰੰਤੂ ਉਸਦਾ ਜਿਹੜਾ ਬਾਪ ਸੀ ਉਹ ਵਿਸ਼ਵਾਸ ਨਹੀਂ ਰੱਖਦਾ ਸੀ ਪਰਮਾਤਮਾ ਵਿੱਚ ਵਿਸ਼ਵਾਸ ਨਾ ਰੱਖਣ ਦਾ ਕਾਰਨ ਉਸ ਦੇ ਬਾਪ ਦਾ ਇਹ ਸੀ ਕਿ ਉਸਦੇ ਲੜਕੀਆਂ ਬਹੁਤ ਸਨ ਉਹ ਹਮੇਸ਼ਾ ਹੰਕਾਰ ਵਿੱਚ ਰਹਿੰਦਾ ਸੀ ਉਹ ਨੀਚ ਕਿਸਮ ਦਾ ਆਦਮੀ ਸੀ ਜੋ ਪਰਮਾਤਮਾ ਨੂੰ ਟਿੱਚ ਵੀ ਨਹੀਂ ਸਮਝਦਾ ਸੀ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਪਰਮਾਤਮਾ ਹੈ ਹੀ ਨਹੀਂ ਉਹ ਬਿਲਕੁਲ ਨਾਸਤਕ ਸੀ ਅਗਰ ਕੋਈ ਘਟਨਾਵਾਂ ਹੁੰਦੀ ਤਾਂ ਉਹ ਕੁਦਰਤ ਦੀ ਦੇਣ ਹੀ ਸਮਝਦਾ ਸੀ ਉਹ ਕਹਿੰਦਾ ਸੀ ਅਗਰ ਪਰਮਾਤਮਾ ਹੁੰਦਾ ਤਾਂ ਮੇਰੇ ਬੇਟਾ ਨਾ ਹੋ ਜਾਂਦਾ ਇਸ ਲਈ ਉਹ ਪਰਮਾਤਮਾ ਨੂੰ ਬਿਲਕੁਲ ਨਹੀਂ ਮੰਨਦਾ ਸੀ ਲੜਕੀਆਂ ਜ਼ਿਆਦਾ ਹੋਣ ਕਾਰਨ ਬੀਬੀ ਰਜਨੀ ਦਾ ਹੰਕਾਰ ਵਿੱਚ ਉਸ ਨੇ ਵਿਆਹ ਇੱਕ ਕੋਹੜੀ ਵਿਅਕਤੀ ਨਾਲ ਕਰ ਦਿੱਤਾ ਬੀਬੀ ਰਜਨੀ ਨੇ ਬੜੇ ਹੌਂਸਲੇ ਨਾਲ ਆਪਣੇ ਪਰਮਾਤਮਾ 'ਤੇ ਵਿਸ਼ਵਾਸ ਰੱਖਦੇ ਹੋਏ ਉਸ ਵਿਅਕਤੀ ਨਾਲ ਆਪਣਾ ਜੀਵਨ ਬਤੀਤ ਕੀਤਾ ਅਤੇ ਉਹ ਆਪਣੇ ਇੱਕ ਵਾਰ ਦੀ ਗੱਲ ਹੈ ਕਿ ਬੀਬੀ ਰਜਨੀ ਆਪਣੀ ਕੋਹੜੀ ਵਿਅਕ ਆਪਣੇ ਕੋਹੜੀ ਬੰਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਗਈ ਜਿੱਥੇ ਰਾਸਤੇ ਵਿੱਚ ਉਸਨੇ ਆਪਣੇ ਆਪਣੇ ਵਿਅਕਤੀ ਆਪਣੇ ਕੋਹੜੀ ਬੰਦੇ ਨੂੰ ਆਪਣੇ ਨਾਲ ਫੜ ਲਿਆ ਅਤੇ ਪਿੱਛੇ ਪਿੱਛੇ ਬਿਠਾ ਕੇ ਲਈ ਗਈ ਉਸਨੂੰ ਵਿਸ਼ਵਾਸ ਸੀ ਕਿ ਆਪਣੇ ਪਰਮਾਤਮਾ 'ਤੇ ਵੀ ਇਹ ਬਿਲਕੁਲ ਠੀਕ ਹੋਵੇਗਾ ਉਸਨੇ ਲੋਕਾਂ ਤੋਂ ਸੁਣਿਆ ਸੀ ਕਿ ਇੱਥੇ ਇਸ ਤਲਾਅ ਵਿੱਚ ਦਰਬਾਰ ਸਾਹਿਬ ਦੇ ਤਲਾਅ ਵਿੱਚ ਵੱਡੇ ਤੋਂ ਵੱਡੇ ਦੁੱਖਾਂ ਦਾ ਨਾਸ਼ ਹੁੰਦਾ ਹੈ ਅਤੇ ਲੋਕ ਵਧੀਆ ਤੰਦਰੁਸਤ ਹੋ ਕੇ ਜਾਂਦੇ ਹਨ ਇਸ ਲਈ ਉਹ ਆਪਣੇ ਬੰਦੇ ਨੂੰ ਆਪਣੇ ਨਾਲ ਬਿਠਾ ਕੇ ਪਿੱਛੇ ਘਸੀਟਦੀ ਹੋਈ ਆਪਣੇ ਨਾਲ ਲੈ ਚਲੀ ਜਦੋਂ ਉਸਨੇ ਉਹ ਕੁਝ ਸਮੇਂ ਲਈ ਬਾਹਰ ਚਲੀ ਗਈ ਕਿਸੇ ਹੋਰ ਪਾਸੇ ਤਾਂ ਉਸਨੇ ਜਦੋਂ ਉਸਦੇ ਬੰਦੇ ਨੇ ਕੋਹੜੀ ਬੰਦੇ ਨੇ ਜਦੋਂ ਤਲਾਅ ਵਿੱਚ ਇਸ਼ਨਾਨ ਕੀਤਾ ਤਾਂ ਉਹ ਬਿਲਕੁਲ ਠੀਕ ਹੋ ਗਿਆ ਬਾਅਦ ਵਿੱਚ ਬੀਬੀ ਰਜਨੀ ਜਦੋਂ ਆਈ ਤਾਂ ਉਸ ਨੇ ਦੇਖਿਆ ਕਿ ਉਸਦਾ ਬੰਦਾ ਬਿਲਕੁਲ ਠੀਕ ਆ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਕਿ ਇਹ ਮੇਰਾ ਬੰਦਾ ਹੈ ਉਹ ਉਸ ਨੂੰ ਕਹਿਣ ਲੱਗੀ ਕਿ ਤੂੰ ਮੇਰੇ ਬੰਦੇ ਨੂੰ ਮਾਰ ਦਿੱਤਾ ਹੈ ਅਤੇ ਉਹ ਉਸਦਾ ਭੇਸ ਧਾਰਨ ਕਰ ਲਿਆ ਹੈ ਪ੍ਰੰਤੂ ਉਹ ਜਦੋਂ ਉਸ ਦੇ ਬੰਦੇ ਨੇ ਉਸਨੂੰ ਘਸੀਟ ਦਿੱਖਣ ਵਾਲਾ ਫੜ ਕੇ ਲੈ ਕੇ ਜਾਣ ਵਾਲਾ ਨਿਸ਼ਾਨ ਦਿਖਾਇਆ ਤਾਂ ਉਸ ਨੂੰ ਯਕੀਨ ਹੋਇਆ ਤਾਂ ਉਸ ਨੇ ਇਸ ਤਰ੍ਹਾਂ ਉਸਨੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕੀਤਾ ਅਤੇ ਉਸ ਨੂੰ ਬਹੁਤ ਫਕਰ ਮਹਿਸੂਸ ਹੋਇਆ ਕਿ ਉਹ ਪਰਮਾਤਮਾ ਨੂੰ ਮੰਨਣ ਵਾਲੀ ਹੈ ਪਰਮਾਤਮਾ ਨੂੰ ਮੰਨਣ ਵਾਲੀ ਹੈ ਜਿਸ ਦੇ ਨਾਲ ਉਸਨੂੰ ਪਰਮਾਤਮਾ ਵਿੱਚ ਵਿਸ਼ਵਾਸ ਹੋ ਗਿਆ ਅਤੇ ਪਰਮਾਤਮਾ ਨੇ ਉਸ ਦੀ ਗੱਲ ਸੁਣ ਲਈ ਇਸ ਦੇ ਲਈ ਪਰਮਾਤਮਾ ਹਰ ਜਗ੍ਹਾ ਦੇ ਵਿੱਚ ਹੈ ਸਿੱਖ ਇਤਿਹਾਸ ਵਿੱਚ ਇਹ ਘਟਨਾ ਬਹੁਤ ਹੀ ਵੱਡੀ ਮੰਨੀ ਜਾਂਦੀ ਹੈ ਇੱਕ ਪਰਮਾਤਮਾ ਅਤੇ ਇਨਸਾਨ ਸੰਬੰਧੀ ਇਹ ਘਟਨਾ ਨਾ ਵੱਡੇ ਪਰਦੇ 'ਤੇ ਦਿਖਾਈ ਜਾ ਰਹੀ ਹੈ ਜਿਸ ਤੋਂ ਸਭ ਸੱਚ ਹੁੰਦਾ ਹੈ ਕਿ ਪਰਮਾਤਮਾ ਹਰ ਜਗ੍ਹਾ ਹਰ ਕਣ ਵਿੱਚ ਹੈ ਸਿੱਖ ਧਰਮ ਦੇ ਇਤਿਹਾਸ ਵਿੱਚ ਮਹਿਲਾਵਾਂ ਨੇਤਾਵਾਂ ਮਾਤਾ ਸਾਹਿਬ ਕੌਰ ਬੀਬੀ ਦੀਵਾਨ ਬੀਬੀ ਰਤਨ ਕੌਰ ਬੀਬੀ ਸੰਤ ਕੌਰ ਦਲੇਰ ਮਹਿਲਾ ਦਾ ਆਉਣਾ ਸਿੱਖ ਇਤਿਹਾਸ ਸਿੱਖ ਧਰਮ ਨੂੰ ਮਜ਼ਬੂਤ ਕਰਨਾ ਵਿੱਚ ਬਹੁਤ ਵੱਡਾ ਅਹਿਮ ਰੋਲ ਅਦਾ ਕਰਦਾ ਹੈ ਅਤੇ ਇਹ ਸਿੱਖ ਇਤਿਹਾਸ ਦੀਆਂ ਬੀਬੀਆਂ ਆਉਣ ਵਾਲੇ ਆਉਣ ਵਾਲੀਆਂ ਬੀਬੀਆਂ ਦੇ ਲਈ ਇੱਕ ਪ੍ਰੇਰਣਾ ਸਰੋਤ ਦਾ ਕੰਮ ਵੀ ਕਰਦੀਆਂ ਹਨ ਅਤੇ ਉਸਨੂੰ ਆਤਮ ਬਲ ਵਿੱਚ ਅਤੇ ਉਹਨਾਂ ਨੂੰ ਆਤਮ ਬਲ ਪੈਦਾ ਕਰਦੀਆਂ ਹਨ